ਬੱਬੂ ਮਾਨ ਮਰਿੰਡੇ ਦੇ ਕੋਲ਼ ਪਿੰਡ ਦਾ ਰਹਿਣ ਵਾਲਾ ਹੈ ਜਿਸ ਕਰ ਇਹ ਗਾਣੇ ਬਹੁਤ ਹੀ ਵਧੀਆ ਗਾਉਂਦਾ ਹੈ ਅਤੇ ਇਹਦੇ ਵਾਲ ਵੀ ਬਹੁਤ ਵਧੀਆ ਲੱਗਦੇ ਹਨ ਬੱਬੂ ਮਾਨ ਦੇ ਨੇ ਫਿਲਮ ਵੀ ਇੱਕ ਕੀਤੀ ਹੈ ਜਿਸਦੀ ਬਹੁਤ ਸੁਪਰ ਹਿੱਟ ਹੋਈ ਉਹਦੇ ਗਾਣੇ ਬਹੁਤ ਫੇਵਰੇਟ ਹੋਏ ਹਨ ਅਤੇ ਇਹਨੇ ਇਹ ਪੰਜਾਬੀ ਨੂੰ ਬਹੁਤ ਅੱਗੇ ਤੱਕ ਲੈ ਕੇ ਆਇਆ ਹੈ ਪੰਜਾਬੀਆਂ ਗਾਣਿਆਂ 'ਚ ਇਹਨੇ ਪਿੰਡਾਂ ਬਾਰੇ ਅਤੇ ਸ਼ਹਿਰਾਂ ਬਾਰੇ ਬਹੁਤ ਕੁੱਝ ਦੱਸਿਆ ਹੈ ਅਤੇ ਅੱਜ ਵੀ ਆਪਣੇ ਪਿੰਡ 'ਚ ਹੀ ਰਹਿ ਰਿਹਾ ਲੋਕਾਂ ਨੇ ਗਾਣੇ ਗਾਉਣ ਵਾਲਿਆਂ ਨੇ ਪਿੰਡ ਛੱਡ ਕੇ ਸ਼ਹਿਰਾਂ 'ਚ ਆ ਗਏ ਨੇ ਪਰ ਇਹ ਅੱਜ ਵੀ ਪਿੰਡਾਂ 'ਚ ਹੀ ਰਹਿ ਰਿਹਾ ਹੈ